ਹਾਂਜੀ ਮੈਂ ਇਹ ਟੁੱਟਿਆ ਤਾਰਾ ਸ਼ੂਟਿੰਗ ਸਟਾਰ ਦੇਖਿਆ ਹੈ ਅਤੇ ਉਹਦੇ ਵਿੱਚ ਮੈਂ ਸਾਰਿਆਂ ਦੀ ਸੁੱਖ ਸ਼ਾਂਤੀ ਅਰਦਾਸ ਲਈ ਹੀ ਪ੍ਰਾਰਥਨਾ ਕੀਤੀ ਹੈ ਅਤੇ ਕਰੋਨਾ ਕਾਲ ਦੇ ਵਿੱਚ ਜ਼ਿਆਦਾ ਮੈਂ ਦੇਖਿਆ ਸੀਗਾ ਕਿ ਉਹਨਾਂ ਦਿਨਾਂ ਵਿੱਚ ਹੀ ਕੀਤੀ ਕਿਉਂਕਿ ਉਹਨਾਂ ਦਿਨਾਂ 'ਚ ਬਹੁਤ ਟਾਈਮ ਮਾੜਾ ਚੱਲ ਰਿਹਾ ਸੀਗਾ ਅਤੇ ਉਸ ਲਈ ਅਰਦਾਸ ਉਸ ਵੇਲੇ ਟਾਈਮ ਜ਼ਰੂਰੀ ਵੀ ਬਹੁਤ ਸੀਗੀ ਅਤੇ ਅਸ ਅਰਦਾਸ ਕੀਤੀ ਸੀਗੀ ਉਸ ਵੇਲੇ